ਇੱਥੇ ਕਈ ਥਾਵਾਂ 'ਤੇ ਅਧਿਆਤਮ ਜਾਂ ਤੰਦਰੁਸਤੀ ਲਈ ਟਰੀਟ ਹੈ ਅੱਜ ਕੱਲ੍ਹ ਦਾ ਨੌਜਵਾਨ ਫਾਸਟ ਫੂਡ ਖਾ ਰਿਹਾ ਹੈ ਇਸ ਕਰਕੇ ਕਈ ਥਾਵਾਂ 'ਤੇ ਕੇਂਦਰ ਬਣਾਏ ਗਏ ਹਨ ਜਿਸ ਵਿੱਚ ਸਾਨੂੰ ਫਾਸਟ ਫੂਡ ਨਾਲ ਕੀ ਕੀ ਬਿਮਾਰੀਆਂ ਹੋ ਸਕਦੀਆਂ ਹਨ ਸਾਡੇ ਸਰੀਰ ਨੂੰ ਕੀ ਕੀ ਨੁਕਸਾਨ ਹੋ ਸਕਦਾ ਇਹ ਦੱਸਦੇ ਹਨ ਅਤੇ ਸਾਨੂੰ ਕੀ ਕੀ ਖਾਣਾ ਚਾਹੀਦਾ ਉਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਵੇਂ ਕਿ ਸਾਨੂੰ ਫ਼ਲ ਫਰੂਟ ਹਰੀ ਸਬਜ਼ੀਆਂ ਜਿਵੇਂ ਕਿ ਪਾਲਕ ਗੋਭੀ ਆਦਿ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਯੋਗਾ ਯੋਗਾ ਕਰਨ ਨਾਲ ਸਾਡੇ ਮੁੱਖ 'ਤੇ ਚ ਇੱਕ ਚਮਕ ਆਉਂਦੀ ਹੈ ਸਾਡਾ ਰੀਰ ਐਕਟਿਵ ਰਹਿੰਦਾ ਹੈ ਅਤੇ ਆਪਾਂ ਕਿਸੇ ਵੀ ਕੰਮ ਨੂੰ ਕਰਨ ਵਿੱਚ ਜਲਦੀ ਥੱਕਦੇ ਨਹੀਂ ਹਾਂ ਯੋਗਾ ਯੋਗਾ ਦੇ ਕਈ ਥਾਵਾਂ 'ਤੇ ਕੈਂਪ ਲੱਗਦੇ ਹਨ ਬਾਬਾ ਰਾਮਦੇਵ ਕਈ ਥਾਵਾਂ 'ਤੇ ਕੈਂਪ ਲਾਉਂਦੇ ਹਨ ਯੋਗਾ ਕਰਨ ਨਾਲ ਸਾਡੀਆਂ ਕਈ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਧਿਆਨ ਧਿਆਨ ਕਰਨ ਨਾਲ ਆਪਾਂ ਕਈ ਚੀਜ਼ਾਂ ਫੋਕਸ ਹੋ ਜਾਂਦੇ ਹਨ ਪੜ੍ਹਾਈ ਲਿਖਾਈ ਚੀਜ਼ਾਂ ਵਿੱਚ ਸਾਡਾ ਮਨ ਲੱਗਣ ਲੱਗ ਪੈਂਦਾ ਹੈ ਆਯੁਰਵੈਦ ਆਯੁਰਵੈਦ ਬਾਬਾ ਰਾਮਦੇਵ ਨਾ 'ਤੇ ਕਈ ਥਾਵਾਂ 'ਤੇ ਕਲੀਨਿਕ ਹਨ ਜਿਸ ਵਿੱਚ ਆਯੁਰਵੈਦ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਇਸ ਵਿੱਚ ਕਈ ਬਿਮਾਰੀਆਂ ਦੇ ਇਲਾਜ ਕੀਤੇ ਜਾਣ ਆਯੁਰਵੈਦ ਸਾਡਾ ਇਤਿਹਾਸ ਦੀ ਸਭ ਤੋਂ ਪਹਿਲੀ ਦਵਾਈ ਦਾ ਨਾਂ ਹੈ